ਅਸੀਂ ਜਿਹੜੀ ਬਾਗਬਾਨੀ ਹਾਂ ਉਹ ਅਸੀਂ ਆਪਣੇ ਘਰ ਵਿੱਚ ਅਤੇ ਅਸੀਂ ਖੇਤ 'ਚ ਬੈਠੇ ਹਾਂ ਸਾਡਾ ਮਕਾਨ ਹੈ ਜਿਹੜਾ ਉਹ ਖੇਤ ਦੇ ਵਿੱਚ ਹੈਗਾ ਸਾਡੇ ਕੋਲ ਛੇ ਕਨਾਲਾਂ ਜ਼ਮੀਨ ਹੈ ਘਰ ਦੇ ਨਾਲ ਅਸੀਂ ਉਹਦੇ ਵਿੱਚ ਬਾਗਬਾਨੀ ਕਰਦੇ ਉਹਦੇ 'ਚ ਫਰੂਟਸ ਫਲਾਂ ਦੇ ਬੂਟੇ ਉਹਦੇ ਵਿੱਚ ਲਾਉਂਦੇ ਹਾਂ ਉਹਦੇ ਵਿੱਚ ਲਾਉਂਦੇ ਹਾਂ ਫਲ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਵੀ ਉਗਾਉਂਦੇ ਹੈਗੇ ਅਤੇ ਉਹਨਾਂ ਦੇ ਵਿੱਚ ਫਲਾਂ ਦੇ ਬੂਟੇ ਹੈਗੇ ਫੁੱਲਾਂ ਦੇ ਬੂਟਿਆਂ 'ਚ ਵੀ ਇੰਟਰਸਟ ਹੈ ਫੁੱਲਾਂ ਦੇ ਵੀ ਅਸੀਂ ਆਪਣੇ ਉੱਥੇ ਹੀ ਲਾਉਂਦੇ ਹੈਗੇ ਹਮ ਅੱਗੇ ਸਾਡੇ ਜਗ੍ਹਾ ਬਣੀ ਹੋਈ ਹੈ ਘਰ ਦੇ ਵਿੱਚ ਵੀ ਅਤੇ ਘਰ ਤੋਂ ਬਾਹਰ ਵੀ ਜਗ੍ਹਾ ਹੈਗੀ ਉਹਨਾਂ ਵਿੱਚ ਲਾਉਂਦੇ ਹਾਂ ਉਹਨਾਂ ਦੀ ਬੁਰੀ ਦੇਖਭਾਲ ਕਰਦੇ ਹੈਗੇ ਘਰ ਦੇ ਵਿੱਚ ਬਈ ਇਹਨਾਂ ਨੂੰ ਕਿਸ ਚੀਜ਼ ਦੀ ਘਾਟ ਆ ਬੂਟਿਆਂ ਨੂੰ ਅਤੇ ਛੱਤ ਦੇ ਵਿੱਚ ਨਹੀਂ ਲਾਏ ਅਸੀਂ ਛੱਤ ਸਾਡੀ ਛੋਟੀ ਸੀਗੀ ਇਸ ਕਰਕੇ ਸਾਡੀ ਜਗ੍ਹਾ ਵੱਧ ਹੈਗੀ ਅਸੀਂ ਨੀਚੇ ਜ਼ਮੀਨ 'ਤੇ ਲਾਉਂਦੇ ਹੈਗੇ ਇਹ ਸਾਨੂੰ ਵਧੀਆ ਲੱਗਦਾ ਜ਼ਮੀਨ 'ਤੇ ਲਾਉਣਾ ਉਹ ਅੱਗੇ ਵੀ ਵੱਧਦੇ ਆ ਜਦੋਂ ਜ਼ਮੀਨ 'ਤੇ ਇੱਕ ਬੂਟੇ ਨੂੰ ਲਾਈਏ ਕਈ ਬੂਟਿਆਂ ਦੀਆਂ ਕਿਸਮਾਂ ਇਹੋ ਜਿਹੀਆਂ ਹਨ ਕਿ ਉਹ ਆਪਣੇ ਆਪ ਹੀ ਅੱਗੇ ਵਧੀ ਜਾਂਦੇ ਹੈਗੇ ਫੁੱਲਾਂ ਵਾਲੇ ਬੂਟਿਆਂ ਦੀਆਂ ਅਤੇ ਜੇ ਫਰੂਟਸ ਵੀ ਜੇ ਉੱਪਰੋਂ ਕੋਈ ਗਿਰਦਾ ਹੈਗਾ ਤਾਂ ਉਹਦਾ ਬੀਜ ਜਿਹੜਾ ਉਹ ਨੀਚੇ ਕਈ ਵਾਰ ਜਦੋਂ ਮਿੱਟੀ 'ਤੇ ਡਿੱਗਦਾ ਤਾਂ ਉਹ ਨੀਚੇ ਆਪਣੇ ਆਪ ਹਰਾ ਹੋ ਜਾਂਦਾ ਹੈਗਾ ਅਤੇ ਜਿਹਦੇ ਕਰਕੇ ਅਸੀਂ ਹੋਰ ਕਿਸੇ ਦੀ ਮਦਦ ਵੀ ਕਰ ਸਕਦੇ ਹਾਂ ਫਰੂ ਬੂਟਾ ਜਾਂ ਜੋ ਫਲਾਂ ਦਾ ਜਾਂ ਫੁੱਲ ਦਾ ਬੂਟਾ ਹੈਗਾ ਉਹ ਅਸੀਂ ਅੱਗੇ ਕਿਸੇ ਨੂੰ ਸਪਲਾਈ ਕਰ ਸਕਦੇ ਹਾਂ ਕਿ ਤਾਂ ਕਿ ਉਹ ਵੀ ਆਪਦੀ ਇੱਛਾ ਪੂਰੀ ਕਰ ਸਕੇ ਉਹਨੂੰ ਵੀ ਇਹ ਚੀਜ਼ ਵਧੀਆ ਲੱਗੇ ਉਹ ਵੀ ਆਪਦੇ ਘਰੇ ਇਸ ਨੂੰ ਆਪਦੇ ਜਗ੍ਹਾ 'ਤੇ ਸਜਾ ਸਕੇ ਅਤੇ ਉਹ ਵੀ ਇਹਦੀ ਦੇਖਭਾਲ ਕਰਕੇ ਅੱਗੇ ਉਸ ਬੂਟੇ ਦੀ ਜਾਂ ਫਲਾਂ ਵਾਲੇ ਬੂਟੇ ਦੀ ਜਾਂ ਫੁੱਲਾਂ ਵਾਲੇ ਬੂਟੇ ਦੀ ਕਿਸਮ ਅੱਗੇ ਵੀ ਵੱਧ ਸਕੇ ਅਸੀਂ ਇਹ ਵੀ ਲੋਕਾਂ ਦੀ ਮਦਦ ਕਰਦੇ ਹਾਂ